ਮੈਂ ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ ਗੱਲ ਕਰ ਰਿਹਾ ਜੀ ਅਤੇ ਮੈਂ ਬੰਦਾ ਸਿੰਘ ਬਹਾਦਰ ਵਿੱਚ ਜੋਬ ਕਰਦਾ ਜੀ ਇਲੈਕਟ੍ਰੀਸ਼ਨ ਦੀ ਇੱਥੇ ਵੱਧ ਤੋਂ ਵੱਧ ਸਟੁਡੈਂਟ ਸਟੂਡੈਂਟ ਬਿਹਾਰ ਤੋਂ ਹਨ ਅਤੇ ਇਹਨਾਂ ਦਾ ਕੰਮ ਮਾੜੀ ਜੀ ਭਾਸ਼ਾ ਹਿੰਦੀ ਬੋਲਦੇ ਜੀ ਇਹ ਇਹਨਾਂ ਨੂੰ ਸਮਝਾ ਸਮਝ ਤਾਂ ਲੱਗ ਜਾਂਦੀ ਹੈ ਪਰ ਬਹੁਤ ਤਰੀਕੇ ਨਾਲ ਮ ਸਮਝਾਉਣਾ ਪੈਂਦਾ ਜੀ ਇਹਨਾਂ ਨੂੰ ਅਤੇ ਵਾਰ ਵਾਰ ਨਹੀਂ ਕਹਿਣਾ ਪੈਂਦਾ ਜੀ ਸਮਝ ਜਾਂਦੇ ਆ ਜੀ ਜਿਹੜਾ ਨਹੀਂ ਸਮਝਦਾ ਉਹਨੂੰ ਚੰਗੀ ਤਰ੍ਹਾਂ ਪੰਜਾਬੀ ਭਾਸ਼ਾ ਸ਼ਮ ਸਮਝਾਈ ਦੀ ਆ ਅਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਹਾਂ ਜੀ ਇਲੈਕਟ੍ਰੀਸ਼ਨ ਦਾ ਕੰਮ ਕਰਦਾਂ ਜੀ ਮੈਂ ਜਿਹੜਾ ਕਹਿ ਦਿੰਦਾ ਕੋਈ ਪੱਖਾ ਕਰਨਾ ਇਹ ਲਾਇਟ ਕਰਨੀ ਹੈ ਕੋਈ ਇਹ ਲਾਇਟ ਨੂੰ ਮਰਕਰੀ ਬੋਲਦੇ ਆ ਕਈ ਵਾਰੀ ਅਸੀਂ ਵੀ ਦਿੱਕਤ 'ਚ ਆ ਜਾਂਦੇ ਆ ਜੀ ਅਤੇ ਮਰਕਰੀ ਕਹਿੰਦੇ ਆ ਜੀ ਫਿਰ ਇਹਨਾਂ ਨੂੰ ਸਮਝਾਉਂਦੇ ਜੀ ਸਾਨੂੰ ਸਮਝਾ ਦਿੰਦੇ ਅਸੀਂ ਇਹਨਾਂ ਨੂੰ ਵੀ ਸਮਝਾਉਂਦੇ ਆ ਇਹ ਭਾਸ਼ਾ ਬਹੁਤ ਵਧੀਆ ਜੀ ਇਹ ਵਧੀਆ ਸੁਭਾਅ ਏ ਇਹਨਾਂ ਦਾ ਵਿਚਾਰਿਆਂ ਦਾ ਮਿਲ ਕੇ ਰਹਿੰਦੇ ਆ ਜੀ ਇਹ ਅਤੇ ਜਦ ਵੀ ਮੈਂ ਕੋਲਜ ਵਿੱਚ ਸਵੇਰੇ ਆਉਂਦਾ ਏ ਜੀ ਕੰਮ 'ਤੇ ਪਹੁੰਚਦਾ ਜੀ ਉਹ ਚਾਰੇ ਬਹੁਤ ਸਤਿਕਾਰ ਨਾਲ ਕਰਦੇ ਆ ਬਹੁਤ ਪਿਆਰ ਕਰਦੇ ਆ ਜੀ ਇਹ ਬੰਦੇ ਬਹੁਤ ਵਧੀਆ ਵਿਚਾਰੇ